ਪਿੰਡਾਂ ਦੇ ਵਿੱਚ ਸਕੂਲ ਸ਼ਹਿਰਾਂ ਦੇ ਸਕੂਲ ਸ਼ਹਿਰਾਂ ਦੇ ਸਕੂਲਾਂ ਦਾ ਸਾਨੂੰ ਦੂਰ ਹੋਣ ਕਾ ਪੈ ਜਾਂਦੇ ਆ ਅਤੇ ਸਕੂਲ ਸ਼ਹਿਰਾਂ ਦੇ ਵਧੀਆ ਅਤੇ ਚੰਗੀਆਂ ਗੱਲਾਂ ਇਹ ਕਿ ਸਕੂਲ ਸ਼ਹਿਰ ਦੇ ਵਿੱਚ ਵੱਧ ਪੜ੍ਹੇ ਲਿਖੇ ਟੀਚਰ ਅਤੇ ਵੱਡੀਆਂ ਬਿਲਡਿੰਗਾਂ ਲੈਬਾਂ ਟੈਸਟ ਕੰਪਿਊਟਰ ਕੰਪਾਟਰ ਵਗੈਰਾ ਹਰ ਇੱਕ ਚੀਜ਼ ਉੱਥੇ ਉਪਲੱਬਧ ਹੁੰਦੀ ਹੈ ਅਤੇ ਪਿੰਡਾਂ ਦੇ ਵਿੱਚ ਜੋ ਕਿ ਇਹ ਚੀਜ਼ਾਂ ਥੋੜ੍ਹਾ ਜਿਹਾ ਔਖੀਆਂ ਹੋ ਜਾਂਦੀਆਂ ਵੀ ਨਹੀਂ ਹੁੰਦੀਆਂ ਅਤੇ ਸ਼ਹਿਰਾਂ ਵਿੱਚ ਜਾਣਾ ਔਖਾ ਪਿੰਡ ਅਤੇ ਸ਼ਹਿਰ ਦੇ ਸਕੂਲ 'ਚ ਇਹ ਗੱਲ ਮਾੜੀ ਹੁੰਦੀ ਹੈ ਕਿ ਪੀ ਮਤਲਬ ਉਹਨਾਂ ਦੀਆਂ ਗੱਲਾਂ ਹੁੰਦੀਆਂ ਕੁਛ ਕਿ ਉਹ ਜ਼ਿਆਦਾਤਰ ਇੰਗਲਿਸ਼ ਅਤੇ ਇੰਗਲਿਸ਼ 'ਚ ਹੀ ਗੱਲ ਕਰਨੀ ਸਿਖਾਉਂਦੇ ਆ ਇੰਗਲਿਸ਼ ਨੂੰ ਪੜ੍ਹਨ ਦਾ ਇੰਗਲਿਸ਼ ਨੂੰ ਜ਼ਿਆਦਾ ਤਰਜੀਹ ਦਿੰਦੇ ਆ ਜੋ ਕੀ ਪੰਜਾਬੀ ਪਿਛੜ ਜਾਂਦੀ ਆ ਫਿਰ ਅਤੇ ਸਾਡੇ ਬੱਚੇ ਜ਼ਿਆਦਾ ਪੜ੍ਹੇ ਲਿਖੇ ਨਾ ਹੋਣ ਕਾਰਨ ਇੰਗਲਿਸ਼ ਤੋਂ ਫਿਰ ਉਹ ਮੁੜ ਕੇ ਪੰਜਾਬੀ ਤੋਂ ਫਿਰ ਜ ਤੁਸੀਂ ਬੱਚੇ ਵੀ ਜਿਵੇਂ ਪੰਜਾਬੀ ਤੋਂ ਫਿਰ ਦੂਰ ਹੁੰਦੇ ਜਾਂਦੇ ਆ ਉਹ ਪੜ੍ਹ ਵੀ ਨਹੀਂ ਸਕਦੇ ਲਿਖ ਵੀ ਨਹੀਂ ਸਕਦੇ ਚੱਜ ਨਾਲ ਬੋਲ ਵੀ ਨਹੀਂ ਸਕਦੇ ਉਹਨਾਂ ਨੂੰ ਪਤਾ ਨਾ ਲੱਗੂ ਅਤੇ ਪਿੰਡਾਂ ਦੀ ਸ਼ਹਿਰਾਂ ਦੀ ਹਾਇਰ ਐਜੂਕੇਸ਼ਨ ਵਧੀਆ ਹੋ ਜਾਂਦੇ ਆ ਚਲੋ ਤੇ ਪਿੰਡਾਂ ਦੇ ਵਿੱਚ ਪੰਜਾਬੀ ਲਾਜ਼ਮੀ ਤੌਰ 'ਤੇ ਪੜ੍ਹਾਈ ਜਾਂਦੀ ਹੈ ਅਤੇ ਪਿੰਡਾਂ ਦੇ ਵਿੱਚ ਜਿਹੜੇ ਸਕੂਲਾਂ ਦੇ ਵਿੱਚ ਮਾੜੀਆਂ ਗੱਲਾਂ ਵੀ ਉਹ ਇਹਨਾਂ ਦੇ ਵਿੱਚ ਜਿਵੇਂ ਛੋਟੀਆਂ ਬਿਲਡਿੰਗਾਂ ਅਤੇ ਜ਼ਿਆਦਾਤਰ ਕੰਪਿਊਟਰ ਵਗੈਰਾ ਅਤੇ ਟੀਚਰਾਂ ਨੂੰ ਸ਼ਹਿਰੋਂ ਆਉਣ ਤੇ ਦਿੱਕਤ ਹੋਣੀ ਥੋੜ੍ਹਾ ਜਿਹਾ ਇਹ ਪ੍ਰੋਬਲਮ ਆ ਜਾਂਦੀਆਂ ਚਲੋ ਟੀਚਰ ਵਧੀਆ ਆ ਪੜ੍ਹਾਉਂਦੇ ਵੀ ਵਧਿਆ